ਪੇਂਡੂ ਖੇਤਰਾਂ ਵਿੱਚ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਨ ਜਿਹੜੀ ਮੁੱਢ ਦਿੱਕਤ ਹੈਗੀ ਉਹ ਹੈਗੀ ਮੌਸਮ ਕਿਉਂਕਿ ਜਦੋਂ ਫਸਲਾਂ ਉਗਾਉਂਦੇ ਹਨ ਤਾਂ ਉਹਨਾਂ ਨੂੰ ਸਹੀ ਮੌਸਮ ਕਿਸੇ ਟਾਈਮ ਜਦੋਂ ਮੰਨ ਲਉ ਕੋਈ ਚੀਜ਼ ਕਰਨੀ ਉਹਨਾਂ ਨੂੰ ਧੁੱਪ ਦੀ ਲੋੜ ਹੈ ਕਿ ਧੁੱਪ ਜ਼ਿਆਦਾ ਤੋਂ ਜ਼ਿਆਦਾ ਆਵੇ ਅਤੇ ਉਹ ਆਉਂਦੀ ਨਹੀਂ ਹੈ ਮੀਂਹ ਪੈ ਜਾਂਦਾ ਜਦੋਂ ਉਹਨਾਂ ਨੂੰ ਮੀਂਹ ਦੀ ਲੋੜ ਹੁੰਦੀ ਹੈ ਉਦੋਂ ਮੀਂਹ ਪੈਂਦਾ ਨਹੀਂ ਹੈ ਅਤੇ ਧੁੱਪ ਆ ਜਾਂਦੀ ਹੈ ਉਹਨਾਂ ਨੂੰ ਇਸ ਚੀਜ਼ ਵਿੱਚ ਕਾਫੀ ਦਿੱਕਤ ਹੁੰਦੀ ਆ ਪੇਂਡੂ ਖੇਤਰਾਂ ਵਿੱਚ ਜਿਹੜੇ ਛੋਟੇ ਕਿਸਾਨ ਆ ਉਹ ਕਿਉਂਕਿ ਉਹ ਫਸਲਾਂ ਹੀ ਓਨੀਆਂ ਉਗਾਉਂਦੇ ਹਨ ਉਹਨਾਂ ਕੋਲ ਜਗ੍ਹਾ ਹੀ ਓਨੀ ਹੁੰਦੀ ਹੈ ਕਿ ਉਹ ਉਗਾਉਂਦੇ ਹਨ ਜੇ ਉਹਨਾਂ ਦੀਆਂ ਚੀਜ਼ਾਂ ਦੇ ਉਹਨਾਂ ਨੂੰ ਪੈਸੇ ਮਿਲ ਜਾਣ ਪਰ ਜਿਹੜੇ ਮੌਸਮ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਦਾਂ ਹੁਣ ਉਹਨਾਂ ਨੂੰ ਮੌਸਮ ਮੀਂਹ ਪੈ ਜਾਂਦਾ ਉਹਨਾਂ ਦੀ ਫਸਲਾਂ ਬਰਬਾਦ ਹੋ ਜਾਂਦੀਆਂ ਇੱਕ ਵਾਰੀ ਜਦੋਂ ਫਸਲਾਂ ਬਰਬਾਦ ਹੋ ਜਾਂਦੀ ਫਿਰ ਸਾਰਾ ਕੁਝ ਬਰਬਾਦ ਹੋ ਜਾਂਦਾ ਕਿ ਫਸਲਾਂ ਕਿਸਾਨ ਦੀ ਸਭ ਤੋਂ ਵੱਡੀ ਚੀਜ਼ ਹੈ ਫਸਲਾਂ ਨਾਲ ਉਹਨਾਂ ਦਾ ਘਰ ਚੱਲਦਾ ਫਸਲਾਂ ਉਹਨਾਂ ਦੀ ਇੱਕ ਸਭ ਤੋਂ ਅਹਿਮ ਚੀਜ਼ ਹੈਗੀ ਹੈ ਜਿਹੜੀ ਉਹਨਾਂ ਦੀ ਲਾਈਫ ਵਿੱਚ ਹੈਗੀ ਆ ਜੋ ਮਿਹਨਤ ਕਰਦੇ ਆ ਕਿੰਨੀ ਕਿੰਨੀ ਮਿਹਨਤ ਕਰਕੇ ਉਹਨਾਂ ਨੂੰ ਪਹਿਲੇ ਇੱਕ ਇੱਕ ਬੀਜ ਲ ਇੱਕ ਇੱਕ ਜ ਜਗ੍ਹਾ ਜਗ੍ਹਾ 'ਤੇ ਪੁਆਇੰਟ ਪੁਆਇੰਟ 'ਤੇ ਉਹਨਾਂ ਨੂੰ ਲਗਾਉਣਾ ਪੈਂਦਾ ਫਿਰ ਕਿੰਨੀ ਕਿੰਨੀ ਦੇਰ ਉਹਨਾਂ ਨੂੰ ਵੇਟ ਕਰਨਾ ਪੈਂਦਾ ਉਹਦਾ ਧਿਆਨ ਰੱਖਣਾ ਪੈਂਦਾ ਫਸਲਾਂ ਉੱਪਰ ਕੀਟਾਣੂ ਜਿਹੜੇ ਕੀੜੇ ਕੁੜੇ ਆਉਂਦੇ ਉਹਨਾਂ ਉੱਤੇ ਉੱਪਰ ਉਹਨਾਂ 'ਤੇ ਦਵਾਈਆਂ ਪਾਉਣੀਆਂ ਪੈਂਦੀਆਂ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਜਿੱਦਾਂ ਮੌਸਮ ਚੇਂਜ ਹੋ ਗਿਆ ਕੁਛ ਚੇਂਜ ਹੋ ਗਿਆ ਉਹਨਾਂ ਨੂੰ ਜਦੋਂ ਉਹ ਚੀਜ਼ ਖਰਾਬ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਕਾਫੀ ਦੁੱਖ ਹੁੰਦਾ ਹੈ ਕਾਫੀ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਇਸ ਕਰਕੇ ਸਾਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਉਹਨਾਂ ਨੂੰ ਉਹਨਾਂ ਦੇ ਪੈਸੇ ਵਧਾਉਣੇ ਚਾਹੀਦੇ ਕਿਸਾਨਾਂ ਦੇ ਤਾਂ ਕਿ ਉਹ ਮਤਲਬ ਕਿ ਉੁਹਨਾਂ ਨੂੰ ਦੁੱਖ ਨਾ ਆਵੇ ਅਗਰ ਉਹਨਾਂ ਦੀ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਉਹਨਾਂ ਨੂੰ ਮਦਦ ਕਰੋ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਉਹਨਾਂ ਦੀ ਅਤੇ ਉਹਨਾਂ ਨੂੰ ਕਾਫੀ ਥੋੜ੍ਹਾ ਜਿਹਾ ਉਹਨਾਂ ਸਹਾਨੂਬੂਤੀ ਅਤੇ ਉਹਨਾਂ ਨੂੰ ਪਿਆਰ ਨਾਲ ਉਹਨਾਂ ਉਹਨਾਂ ਦੀ ਜਿਹੜੀ ਵੀ ਉਹਨਾਂ ਦੀ ਦਿੱਕਤ ਹੈਗੀ ਉਹ ਸੁਧਾਰਨੀ ਚਾਹੀਦੀ ਹੈ ਇਸ ਕਰਕੇ ਸਾਨੂੰ ਕਿਸਾਨਾਂ ਦਾ ਸਹਿਯੋਗ ਕਰਨਾ ਚਾਹੀਦਾ